ਇਸ ਖੇਤਰ ਵਿੱਚ ਬਹੁਤ ਸਾਰੇ ਮਾਰਗਦਰਸ਼ਨ ਪਾਏ ਜਾਂਦੇ ਹਨ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਵਿੱਚ ਅੰਮ੍ਰਿਤ ਛਕਦੇ ਹਾਂ ਦ ਦੋ ਟਾਈਮ ਗੁਰਦੁਆਰਾ ਸਾਹਿਬ ਜਾਂਦੇ ਹਾਂ ਸਵੇਰੇ ਨਿਤਨੇਮ ਕਰਦੇ ਹਾਂ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ ਗੁਰਦੁਆਰਾ ਸਾਹਿਬ ਜਾ ਕੇ ਗੁਰਬਾਣੀ ਕੀਰਤਨ ਸੁਣਦੇ ਹਾਂ ਅਤੇ ਸੇਵਾ ਕਰਦੇ ਹਾਂ ਲੰਗਰ ਵਿੱਚ ਵੀ ਸੇਵਾ ਕਰਦੇ ਹਾਂ ਜੋੜਿਆਂ ਦੀ ਸੇਵਾ ਕਰਦੇ ਹਾਂ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਹਾਂ ਅਤੇ ਦੂਜੇ ਪਾਸੇ ਅਸੀਂ ਸਤਸੰਗ ਘਰ ਵੀ ਜਾਦੇ ਹਾਂ ਸਤਸੰਗ ਘਰ ਜਾ ਕੇ ਗੁਰੂ ਜੀ ਦੀ ਬਾਣੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਉੱਥੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਗੁਰੂ ਨਾਲ ਦਾ ਪਾਠ ਕਰਨ ਦਾ ਤਰੀਕਾ ਦੱਸਿਆ ਜਾਂਦਾ ਹੈ ਅਤੇ ਅਸੀਂ ਉੱਥੇ ਝਾੜੂ ਦੀ ਸੇਵਾ ਵੀ ਕਰਦੇ ਹਾਂ ਅਤੇ ਵਿਛਾਈ ਦੀ ਸੇਵਾ ਵੀ ਕਰਦੇ ਹਾਂ